ਯਾਤਰਾ ਕਰਨ ਸਮੇਂ ਸਾਨੂੰ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਐ ਜਿਵੇਂ ਕਿ ਅਗਰ ਅਸੀਂ ਸਰਦੀ ਵਿੱਚ ਸਰਦੀ ਦੇ ਮੌਸਮ ਵਿੱਚ ਕਿਤੇ ਜ਼ਿਆਦਾ ਦੂਰ ਏਰੀਏ 'ਚ ਜਾਣਾ ਹੋਵੇ ਤਾਂ ਸਾਨੂੰ ਆਪਣੇ ਮੋਟੇ ਕੱਪੜਿਆਂ ਨੂੰ ਨਾਲ ਲੈ ਕੇ ਅਤੇ ਪਾ ਕੇ ਜਾਣਾ ਚਾਹੀਦਾ ਹੈ ਅਤੇ ਯਾਤਰਾ ਨੂੰ ਆਰਾਮਦਾਇਕ ਬਣਾਉਣ ਦੇ ਲਈ ਸਾਨੂੰ ਟ੍ਰੇਨਾਂ ਦੀ ਟਿਕਟਾਂ ਆਪਣੇ ਆਪ ਬੁੱਕ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਬੈਠਣ ਜਾਂ ਸੀਟ ਮਿਲਣ 'ਚ ਕੋਈ ਦਿੱਕਤ ਨਾ ਆਵੇ ਅਤੇ ਕਿਸੇ ਦੀ ਸਿਹਤ ਖਰਾਬ ਹੋਣ ਤੋ ਤੋਂ ਬਚਾਅ ਕਰਨ ਦੇ ਲਈ ਸਾਨੂੰ ਆਪਣੇ ਨਾਲ ਹਰ ਤਰ੍ਹਾਂ ਦੀ ਦਵਾਈ ਰੱਖਣੀ ਚਾਹੀਦੀ ਹੈ ਜਿਵੇਂ ਕਿ ਸਿਰਦਰਦ ਖਾਂਸੀ ਜੁਖਾਮ ਵਗੈਰਾ ਦੀ ਨਾਲ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਨਾਲ ਹਮੇਸ਼ਾ ਦੋ ਟਾਈਮ ਦਾ ਖਾਣਾ ਜ਼ਰੂਰ ਕੈਰੀ ਕਰਨਾ ਚਾਹੀਦਾ ਤਾਂ ਕਿ ਅਸੀਂ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੀਏ ਅਤੇ ਸਾਨੂੰ ਬਿਮਾਰੀਆਂ ਨਾ ਲੱਗਣ ਘਰ ਦਾ ਖਾਣਾ ਖਾਣਾ ਹੀ ਸਭ ਤੋਂ ਵਧੀਆ ਹੈ ਅਤੇ ਯਾਤਰਾ ਟਾਈਮ ਇੱਕ ਹੋਰ ਧਿਆਨ ਰੱਖਣਾ ਹੈ ਕਿ ਆਪਣਾ ਸਮਾਨ ਆਪਣੇ ਕੋਲ ਹੀ ਰੱਖੀਏ ਕਿਤੇ ਆਲੇ ਦੁਆਲੇ ਨਾ ਰੱਖੀਏ ਕਿਉਂਕਿ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੁੰਦੀ ਹੈ ਅਗਰ ਕੋਈ ਸਮਾਨ ਇੱਧਰ ਉੱਧਰ ਚੋਰੀ ਹੋ ਜਾਂਦਾ ਹੈ ਤਾਂ ਕੋਈ ਵੀ ਕਿਸੇ ਦਾ ਮਦਦ ਨਹੀਂ ਕਰਦਾ